ਪੌਦੇ ਉਗਾਉਣ ਲਈ ਰੇਤਲੀ ਅਤੇ ਸਿਓਟੀ ਮਿੱਟੀ ਦੀ ਵਰਤੋਂ ਕਰਦੇ ਹਨ ਉਹਦੇ ਉਸ ਪੌਦੇ ਉਸ ਵਿੱਚ ਪੌਦੇ ਵਧੀਆ ਤਰੀਕੇ ਨਾਲ ਉੱਗਦੇ ਹਨ ਪੌਦੇ ਨੂੰ ਵਧੀਆ ਗ੍ਰੋਥ ਦੇਣੇ ਵਾਸਤੇ ਰੇਤਲੀ ਮਿੱਟੀ ਬਹੁਤ ਹੀ ਉਪਜਾਊ ਹੁੰਦੀ ਹੈ ਜੋ ਕਿ ਉਸ ਵਿੱਚ ਪੌਦੇ ਲਗਾਏ ਜਾਂਦੇ ਹਨ ਉਸ ਵਿੱਚ ਅਸੀਂ ਗੰਡੋਆ ਕਪੋਸਟ ਖਾਦ ਵੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਪੌਦੇ ਨੂੰ ਬਹੁਤ ਛੇਤੀ ਮਤਲਬ ਬਹੁਤ ਛੇਤੀ ਵਧਾਉਂਦੀ ਹੈ ਜੋ ਕਿ ਕੁਝ ਦਿਨਾਂ ਵਿੱਚ ਹੀ ਇੱਕ ਵਧੀਆ ਪੌਦਾ ਤਿਆਰ ਹੋ ਜਾਂਦਾ ਹੈ ਉਸ ਦੇਸੀ ਖਾਦ ਪਾਈ ਜਾਂਦੀ ਹੈ ਜੋ ਜਿਸ ਨੂੰ ਓਰਗੈਨਿਕ ਜਾਂ ਗੰਡੋਆ ਖਾਦ ਵੀ ਕਿਹਾ ਜਾਂਦਾ ਹੈ ਪੌਦਿਆਂ ਨੂੰ ਉਗਾਉਣ ਵਾਸਤੇ ਬਹੁਤ ਲਾਹੇਵੰਦ ਖਾਦ ਹੁੰਦੀ ਹੈ ਜੋ ਕਿ ਹਰੇਕ ਕਿਸਾਨ ਵਰਤਦਾ ਹੈ ਅਸੀਂ ਵੀ ਉਸ ਨੂੰ ਵਰਤਦੇ ਹਨ ਅਤੇ ਮਿੱਟੀ ਸਿਓਟੀ ਰੇਤਲੀ ਮਿੱਟੀ ਬਹੁਤ ਉਪ ਉਪਜਾਊ ਹੁੰਦੀ ਹੈ ਜੋ ਕਿ ਪੌਦਿਆਂ ਵਾਸਤੇ ਬਹੁਤ ਵਧੀਆ ਅਤੇ ਲਾਹੇਵੰਦ ਸਾਬਤ ਹੁੰਦੀ ਹੈ